ਬੈਂਕ ਅਧਿਕਾਰੀ ਨਾਲ ਗੱਲ ਕਰਨ 'ਤੇ ਸਾਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ ਜਿਵੇਂ ਕਿ ਕਾਲ ਸ਼ੁਰੂ ਕਰਨ 'ਤੇ ਸਭ ਤੋਂ ਪਹਿਲਾਂ ਆਪਣਾ ਨਾਮ ਅਤੇ ਅਕਾਊਂਟ ਨੰਬਰ ਦੱਸੋ ਜਿਵੇਂ ਹੈਲੋ ਮੇਰਾ ਨਾਮ ਰਾਹੁਲ ਹੈ ਅਤੇ ਮੇਰੇ ਕੋਲ ਐੱਨ ਪੀ ਐੱਸ ਅਕਾਊਂਟ ਨੰਬਰ ਡੈਸ਼ ਹੈ ਕਾਲ ਕਰਦੇ ਸਮੇਂ ਸਾਨੂੰ ਕੁਛ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ ਜਿਵੇਂ ਐੱਨ ਪੀ ਐੱਸ ਅਕਾਊਂਟ ਦਾ ਅਡਰੈਸ ਅਪਡੇਟ ਕਰਨਾ ਚਾਹੁੰਦਾ ਹਾਂ ਇਹ ਅਧਿਕਾਰੀ ਨੂੰ ਕਹਾਂਗੇ ਕਿ ਸਾਨੂੰ ਪਹਿਲਾਂ ਤੋਂ ਹੀ ਕਿਤੇ ਸ਼ਿਫਟ ਕਰਨਾ ਹੈ ਅਤੇ ਮੈਂ ਆਪਣਾ ਅਕਾਊਂਟ ਅਪਡੇਟ ਕਰਨਾ ਹੈ ਤੁਸੀਂ ਆਪਣੀ ਪੁਰਾਣੀ ਅਡਰੈਸ ਅਤੇ ਨਵੀਂ ਅਡਰੈਸ ਦੀ ਜਾਣਕਾਰੀ ਸਾਫ਼ ਸਾਫ਼ ਦੱਸੋ ਮੇਰੀ ਪੁਰਾਣੀ ਅਡਰੈਸ ਹੈ ਡੈਸ਼ ਅਤੇ ਮੇਰੀ ਨਵੀਂ ਅਡਰੈਸ ਹੈ ਨਵੀਂ ਅਡਰੈਸ ਡੈਸ਼ ਅਤੇ ਕੋਈ ਇਹ ਪੁੱਛੋ ਕਿ ਕੋਈ ਡੌਕੂਮੈਂਟ ਜਾਂ ਪਰੂਫ ਚਾਹੀਦੇ ਹਨ ਅਡਰੈਸ ਅਪਡੇਟ ਕਰਨ ਲਈ ਕੀ ਦੱਸ ਸਕਦੇ ਹੋ ਕੋਈ ਡੌਕੂਮੈਂਟ ਪਰੂਫ ਪ੍ਰਸੈਸ ਲਈ ਚਾਹੀਦੇ ਹਨ ਇੰਕੁਐਰੀ ਪ੍ਰਸੈਸ ਬਾਰੇ ਵਿੱਚ ਪੁੱਛੋ ਇਹ ਅਪਡੇਟ ਕਰਨ ਲਈ ਕਿੰਨਾ ਸਮਾਂ ਲੱਗ ਸਕਦਾ ਹੈ ਕੀ ਮੈਂ ਕੋਈ ਕੰਫਰਮੇਸ਼ਨ ਮਿਲੂ ਧੰਨਵਾਦ ਅਫਸਰ ਇਹ ਸਭ ਕਰਨ ਤੋਂ ਬਾਅਦ ਉਨ੍ਹਾਂ ਅਫਸਰ ਨੂੰ ਸ਼ੁਕਰੀਆ ਅਦਾ ਕਰੋ ਤੁਹਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਮਦਦ ਕਰਨ ਲਈ